ਮੇਰਾ ਪਸੰਦੀਦਾ ਲੇਖਕ ਚੇਤਨ ਭਗਤ ਹੈ ਕਿਉਂਕਿ ਉਸ ਦੀਆਂ ਬਹੁਤ ਹੀ ਕਿਤਾਬਾਂ ਪੜ੍ਹਨ ਨੂੰ ਮਿਲਦੀਆਂ ਹਨ ਅਤੇ ਉਸ ਦੀਆਂ ਕਿਤਾਬਾਂ ਵਿੱਚੋਂ ਸਾਨੂੰ ਬਹੁਤ ਕੁਝ ਹੀ ਸਿੱਖਣ ਨੂੰ ਮਿਲਦਾ ਹੈ ਹਾਲ ਹੀ ਵਿੱਚ ਮੈਂ ਉਸਦੀ ਇੱਕ ਕਿਤਾਬ ਪੜ੍ਹੀ ਸੀ ਟੂ ਸਟੇਟਸ ਜਿਸ ਉੱਤੇ ਕਿ ਇੱਕ ਫਿਲਮ ਵੀ ਬਣ ਚੁੱਕੀ ਹੈ ਉਸ ਦੀਆਂ ਲਿਖਤਾਂ ਉਸਦੀਆਂ ਕਈ ਲਿਖਤਾਂ ਅਤੇ ਕਈ ਫਿਲਮਾਂ ਬਣ ਚੁੱਕੀਆਂ ਹਨ ਅਤੇ ਉਹ ਬਚਪਨ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਤੋਂ ਉੱਠ ਕੇ ਬਹੁਤ ਹੀ ਵੱਡੇ ਲੇਖਕ ਬਣੇ ਹਨ ਅਤੇ ਉਹਨਾਂ ਦੀਆਂ ਕਿਤਾਬਾਂ ਬਹੁਤ ਲੋਕ ਪੜ੍ਹਦੇ ਹਨ ਉਸ ਲੇਖਕ ਵਜੋਂ ਦੱਸੀਏ ਤਾਂ ਉਸ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਦੇਖਿਆ ਹੈ ਅਤੇ ਉਹ ਇਹ ਸਭ ਆਪਣਾ ਦੇਖਿਆ ਹੀ ਆਪਣੀਆਂ ਕਿਤਾਬਾਂ ਵਿੱਚ ਬਿਆਨ ਕਰਦਾ ਹੈ ਸਾਨੂੰ ਉਸ ਦੀਆਂ ਲਿਖੀਆਂ ਕਿਤਾਬਾਂ ਤੋਂ ਹਮੇਸ਼ਾਂ ਹੀ ਕੁਝ ਨਾ ਕੁਝ ਅਲੱਗ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਸਾਨੂੰ ਜੀਵਨ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਕਿਸ ਤਰ੍ਹਾਂ ਲੋਕਾਂ ਨਾਲ਼ ਵਿਚਰਨਾ ਹੈ ਕਿਸ ਤਰ੍ਹਾਂ ਆਪਣੇ ਕੰਮ ਕਰਨੇ ਹਨ ਅਤੇ ਸਾਨੂੰ ਇਸੇ ਤਰ੍ਹਾਂ ਹੀ ਬਹੁਤ ਕੁਝ ਸਿੱਖਣ ਨੂੰ ਅਲੱਗ ਅਲੱਗ ਤਰ੍ਹਾਂ ਦਾ ਮਿਲਦਾ ਹੈ